ਜਦੋਂ ਵੀ ਮੇਰੇ ਦਿਮਾਗ 'ਚ ਬਹੁਤ ਕੁਛ ਚੱਲਦਾ ਹੁੰਦਾ ਆ ਤਾਂ ਮੈਂ ਡਰੋਇੰਗ ਕਰਦੀ ਹਾਂ ਅਤੇ ਮੈਨੂੰ ਡਰੋਇੰਗ ਕਰਨ ਲਈ ਇੱਕ ਸ਼ਾਂਤੀਪੂਰਵਕ ਜਗ੍ਹਾ ਚਾਹੀਦੀ ਸੀਗੀ ਜੋ ਕਿ ਮੇਰੀ ਸਿਸਟਰ ਪਹਾੜਾਂ 'ਚ ਰਹਿੰਦੀ ਹੈ ਅਤੇ ਮੈਂ ਉਨ੍ਹਾਂ ਕੋਲ ਚਲੀ ਗਈ ਅਤੇ ਓਥੋਂ ਦਾ ਮੈਨੂੰ ਵਿਊ ਬਹੁਤ ਵਧੀਆ ਲੱਗਿਆ ਅਤੇ ਮੈਂ ਓਥੇ ਡਰੋਇੰਗ ਕੀਤੀ ਅਤੇ ਡਰੋਇੰਗ ਕਰਨ ਤੋਂ ਬਾਅਦ ਸਾਰਿਆਂ ਨੂੰ ਡਰੋਇੰਗ ਬਹੁਤ ਪਸੰਦ ਆਈ ਅਤੇ ਉਨ੍ਹਾਂ ਦੇ ਆਂਢ ਗੁਆਂਢ ਦੇ ਵਿੱਚ ਵੀ ਡਰੋਇੰਗ ਬਹੁਤ ਪਸੰਦ ਆਈ ਅਤੇ ਮੈਂ ਦੋ ਤਿੰਨ ਡਰੋਇੰਗਾਂ ਬਣਾਈਆਂ